ਪੰਜਾਬੀ ਲੋਕਾਂ ਦੀ ਪਹਿਛਾਣ ਉਹਨਾ ਦੇ ਬੋਲਣ ਤੋਂ ਹੁੰਦੀ ਹੈ ਉਹਨਾਂ ਦੇ ਬੋਲਣ ਵਿੱਚ ਬਹੁਤ ਮਿਠਾਸ ਹੁੰਦੀ ਹੈ ਤਾਂ ਹੀ ਉਹ ਹਰ ਇੱਕ ਖਿੱਚ ਦਾ ਕੇਂਦਰ ਬਣੇ ਹੁੰਦੇ ਹਨ ਹਰ ਇੱਕ ਨੂੰ ਖਿੜੇ ਮੱ ਖਿੜੇ ਮੱਥੇ ਮਿਲਦੇ ਹਨ ਅਤੇ ਸਭ ਨੂੰ ਆਦਰ ਸ ਸਤਿਕਾਰ ਨਾਲ ਬੁਲਾਉਂਦੇ ਹਨ ਅਤੇ ਆਪਣੀਆਂ ਭਾਵਨਾਵਾਂ ਨੂੰ ਵੀ ਖੁੱਲ੍ਹ ਕੇ ਪ੍ਰਗਟ ਕਰਦੇ ਪੰਜਾਬੀ ਲੋਕ ਹਰ ਇੱਕ ਦੀ ਨਾਲ ਖੜ੍ਹੇ ਹੁੰਦੇ ਹਨ ਭਾਵੇਂ ਖੁਸ਼ੀ ਦਾ ਮੌਕਾ ਹੋਵੇ ਭਾਵੇਂ ਦੁੱਖ ਦਾ ਸਮਾਂ ਹੋਵੇ ਕਦੇ ਵੀ ਕਦੇ ਵੀ ਕਿਸੇ ਨੂੰ ਨਹੀਂ ਪਿੱਛੇ ਨਹੀਂ ਹਟਦੇ ਪੰਜਾਬੀ ਪਗ ਪੰਜਾਬੀ ਅਖਣ ਬਹੁਤ ਵਧੀਆ ਬਣਾਉਂਣ ਵਾਸਤੇ ਵੱਖਰੇ ਵੱਖਰੇ ਅਖਾਣਾ ਦੀ ਵਰਤੋਂ ਕਰਦੇ ਹਨ ਜਿਸ ਨਾਲ ਭਾਸ਼ਾ ਨੂੰ ਬਹੁਤ ਵਧੀਆ ਪ੍ਰਫੁਲਿੱਤ ਕੀਤਾ ਜਾਂਦਾ ਹੈ